ਪਿਛਲੇ ਕੁੱਝ ਸਾਲਾਂ ਵਿੱਚ ਮੋਹਾਲੀ ਜ਼ਿਲ੍ਹੇ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਸਰਕਾਰ ਨੇ ਇੱਥੇ ਵੱਡੀਆਂ ਵੱਡੀਆਂ ਬਾਹਰਲੀਆਂ ਕੰਪਨੀਆਂ ਨੇ ਇੱਥੇ ਆਪਣੀ ਇਨਵੈਸਟਮੈਂਟ ਕੀਤੀ ਹੈ ਪੈਸਾ ਆਪਣਾ ਨਿਵੇਸ਼ ਕੀਤਾ ਹੈ ਜਿਸ ਨਾਲ਼ ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਹੀ ਜ਼ਿਆਦਾ ਤਰੱਕੀ ਹੋਈ ਹੈ ਪਹਿਲਾਂ ਉਰੇ ਕਿੱਲੇ ਨੂੰ ਕੋਈ ਪੁੱਛਦਾ ਸੀ ਵੀ ਨੀ ਸੀ ਕੋਈ ਕਹਿੰਦਾ ਸੀ ਉਰੇ ਕਿਆ ਕਿੱਲੇ ਉਰੇ ਜ਼ਮੀਨਾਂ ਏ ਅੱਜ ਦੇ ਟੈਮ ਅੱਜ ਤੋਂ ਦਸ ਸਾਲ ਪਹਿਲਾਂ ਤੇ ਅੱਜ ਦਾ ਟੈਮ ਅੱਜ ਉਰੇ ਦਸ ਕਿੱਲੇ ਵੇਚ ਕੇ ਵੀ ਪਟਿਆਲੇ ਵਾਲੇ ਮੋਹਾਲੀ ਜ਼ਿਲ੍ਹੇ 'ਚ ਇੱਕ ਕਿੱਲਾ ਨਹੀਂ ਲੈ ਸਕਦਾ ਬੰਦਾ ਉਰੇ ਅੱਠ ਨੌ ਕਰੋੜ ਦਾ ਕਿੱਲਾ ਹੋ ਚੁੱਕਿਆ ਹੈ ਕਿਤੇ ਕਿਤੇ ਤਾਂ ਪੰਦਰਾਂ ਕਰੋੜ ਦਾ ਕਿੱਲਾ ਏ ਇੱਥੇ ਵੱਡੇ ਵੱਡੇ ਰੋਡ ਵੱਡੇ ਵੱਡੇ ਆਫ਼ਿਸ ਖੁੱਲ੍ਹੇ ਹਨ ਅਤੇ ਇੱਥੇ ਲਿੰਕ ਰੋਡ ਬਹੁਤ ਬਣੇ ਹਨ ਚੰਡੀਗੜ੍ਹ ਇਸ ਦੇ ਨਜ਼ਦੀਕ ਪੈ ਜਾਂਦਾ ਹੈ ਇੱਧਰ ਪਟਿਆਲੇ ਨੂੰ ਲਿੰਕ ਰੋਡ ਹੈ ਅਤੇ ਨਵੇਂ ਸ਼ਹਿਰ ਨੂੰ ਲਿੰਕ ਰੋਡ ਹੈ ਆਪਣਾ ਬਾਘਾਂ ਵਾਲ਼ੇ ਨੂੰ ਲਿੰਕ ਰੋਡ ਹੈ ਇਸ ਨਾਲ਼ ਫੈਕਟਰੀਆਂ ਦਾ ਵੀ ਵਾਧਾ ਬਹੁਤ ਹੋਇਆ ਉਹਨਾਂ ਦੇ ਕਾਰੋਬਾਰਾਂ 'ਚ ਬਹੁਤ ਜ਼ਿਆਦਾ ਉਹ ਚੱਲੀ ਹੈ ਲੋਕਾਂ ਨੂੰ ਰੋਜ਼ਗਾਰ ਬਹੁਤ ਜ਼ਿਆਦਾ ਮਿਲਿਆ ਹੈ ਕਿਉਂਕਿ ਇੱਥੇ ਬਹੁਤ ਜ਼ਿਆਦਾ ਤਰੱਕੀ ਹੋਈ ਹੈ